ਸਤਿ ਸ਼੍ਰੀ ਅਕਾਲ ਤੁਸੀਂ ਅਨੰਦ ਏਜੰਸੀ ਤੋਂ ਗੱਲ ਕਰਦੇ ਹੋ ਤੁਹਾਡਾ ਨੰਬਰ ਮੈਨੂੰ ਮੇਰੇ ਦੋਸਤ ਅਮਨ ਨੇ ਦਿੱਤਾ ਸੀ ਜੋ ਕਿ ਤੁਹਾਡੇ ਨਾਲ ਕੁਝ ਦਿਨ ਪਹਿਲਾਂ ਮਨਾਲੀ ਹਿਮਾਚਲ ਪ੍ਰਦੇਸ਼ ਗਿਆ ਸੀ ਉਸ ਨੇ ਤੁਹਾਡੀ ਕੈਬ ਸਰਵਿਸ ਬਾਰੇ ਦੱਸਿਆ ਕਿ ਤੁਹਾਡੀ ਸਰਵਿਸ ਬਹੁਤ ਵਧੀਆ ਸੀ ਉਸ ਨੂੰ ਮੁੱਖ ਰੱਖਦੇ ਹੋਏ ਅਸੀਂ ਵੀ ਕੱਲ੍ਹ ਰਾਤ ਨੂੰ ਚੰਡੀਗੜ੍ਹ ਹਵਾਈ ਅੱਡੇ ਜਾਣਾ ਹੈ ਇਸ ਫਲਾਈਟ ਰਾਹੀਂ ਅਸੀਂ ਚੰਡੀਗੜ੍ਹ ਤੋਂ ਮੁੰਬਈ ਜਾਣਾ ਹੈ ਜਿਸ ਦਾ ਸਮਾਂ ਰਾਤ ਬਾਰ੍ਹਾਂ ਵੱਜ ਕੇ ਚਾਲ਼ੀ ਮਿੰਟ ਹੈ ਜਿੱਥੇ ਕਿ ਮੇਰੇ ਦੋਸਤ ਦਾ ਐਕਸੀਡੈਂਟ ਹੋਇਆ ਹੈ ਉਹ ਹਸਪਤਾਲ 'ਚ ਦਾਖਲ ਹੈ ਅਤੇ ਉਸ ਨੂੰ ਖੂਨ ਏ ਪੋਜ਼ੀਟਿਵ ਦੀ ਲੋੜ ਹੈ ਮੈਂ ਉਸ ਨੂੰ ਆਪਣਾ ਖੂਨ ਦੇਣ ਲਈ ਜਾਣਾ ਹੈ ਉਸ ਨੂੰ ਖੂਨ ਦੇ ਪੋ ਖੂਨ ਏ ਪੋਜ਼ੀਟਿਵ ਦੀ ਲੋੜ ਹੈ ਜੋ ਕਿ ਉੱਥੇ ਉਪਲਬਧ ਨਹੀਂ ਹੈ ਕਿਰਪਾ ਕਰਕੇ ਮੈਨੂੰ ਹਵਾਈ ਅੱਡਾ ਚੰਡੀਗੜ੍ਹ ਵਿਖੇ ਜਲਦੀ ਪਹੁੰਚਾ ਦਿਓ ਤਾਂ ਕਿ ਮੈਂ ਠੀਕ ਸਮੇਂ ਸਿਰ ਆਪਣੇ ਦੋਸਤ ਨੂੰ ਆਪਣਾ ਖੂਨ ਦੇ ਸਕਾਂ ਅਤੇ ਉਸ ਦੀ ਜ਼ਿੰਦਗੀ ਨੂੰ ਬਚਾਅ ਸਕਾਂ ਆਪ ਜੀ ਦਾ ਬਹੁਤ ਧੰਨਵਾਦ